ਸਤਿ ਸ਼੍ਰੀ ਅਕਾਲ ਜੀ ਅਸ ਖ਼ਬਰ ਉਦਯੋਗ ਆਜ਼ਾਦੀ ਦੀ ਅਭਿਆਸ ਇਹ ਹੈ ਕਿ ਸਾਨੂੰ ਕਈ ਮਤਲਬ ਕਿ ਮੇ ਮੈਂ ਕਈ ਆਜ਼ਾਦੀ ਦੀਆਂ ਅਜਾ ਆਜ਼ਾਦੀ ਆਪਾਂ ਨੂੰ ਖੁਦ ਨੂੰ ਲੜਨੀ ਪੈਂਦੀ ਹੈ ਕਈ ਵਾਰ ਆਪਾਂ ਨੂੰ ਸਾਹਮਣੇ ਹੋ ਕੇ ਵੀ ਉਹ ਕਰਨਾ ਪੈਂਦਾ ਕਈ ਮਤਲਬ ਸਾਹਮਣੇ ਆਪਾਂ ਨੂੰ ਆਜ਼ਾਦੀ ਆਜ਼ਾਦ ਆਜ਼ਾਦ ਨੇਤਾ ਮਤਲਬ ਸਾਮਣ ਸਾਹਮਣੇ ਸਾਰਾ ਕੁਛ ਕਰ ਦਿੰਦੇ ਕਈ ਆਪਾਂ ਨੂੰ ਦੇ ਲਈ ਉਹ ਆਪਣੀਆਂ ਅੰਦਰਲੀਆਂ ਗਤੀਵਿਧੀਆਂ ਨੂੰ ਸਾਂਭ ਕੇ ਰੱਖਦੇ ਆ ਲੁਕੋ ਲੁਕੋ ਕੇ ਦ ਦ੍ਰਿਸ਼ ਦਿਖਾਉਂਦੇ ਨੇ